ਮੈਂ ਅਤੇ ਮੇਰੇ ਨਾਲ ਦੇ ਦੋਸਤ ਪਹਾੜਾਂ ਵਿੱਚ ਘੁੰਮਣ ਦਾ ਪਲੈਨ ਬਣਾ ਰਹੇ ਹਾਂ ਜਿਸ ਕਰਕੇ ਸ ਅਸੀਂ ਆਪਣੀ ਉਬਰ ਜਾਂ ਆਪਣੀ ਗੱਡੀ ਬੁੱਕ ਕਰਨਾ ਚਾਹੁੰਦੇ ਹਾਂ ਮ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਟਰੈਵਲਿੰਗ ਏਜੰਸੀ ਵਾਲੇ ਟਰੈਵਲਸ ਲਈ ਅਤੇ ਆਪਣੀ ਉਬਰਸ ਨੂੰ ਪ੍ਰਦਾਨ ਕਰਦੇ ਹੋ ਸੋ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਡਾ ਆਰਡਰ ਵੀ ਸਮੇਂ ਸਿਰ ਪੂਰਾ ਕਰੋਗੇ ਅਤੇ ਸਾਨੂੰ ਵਧੀਆ ਸੁਵਿਧਾਵਾਂ ਪ੍ਰਾਪਤ ਕਰਾਓਗੇ ਜਿਸ ਕਾਰਨ ਸਾਨੂੰ ਟਰੈਵਲ ਜਾਂ ਘੁੰਮਣ ਵਿੱਚ ਕੋਈ ਵੀ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇਗਾ ਅਸੀਂ ਅਠਾਰ੍ਹਾਂ ਮਈ ਸਵੇਰੇ ਅੱਠ ਵਜੇ ਨਿਕਲਣਾ ਚਾਹੁੰਦੇ ਹਾਂ ਅਤੇ ਸਾਨੂੰ ਪਿਕਮ ਪਿਕਅੱਪ ਕਰਨ ਦਾ ਸਥਾਨ ਪਠਾਨਕੋਟ ਬੱਸ ਸਟੈਂਡ ਹੋਵੇਗਾ ਉਮੀਦ ਕ ਤੁਸੀਂ ਆਪ ਦਾ ਡਰਾਈਵਰ ਤੁਸੀਂ ਆਪਦਾ ਡਰਾਈਵਰ ਪੂਰੇ ਅੱਠ ਵਜੇ ਪਿਕਅੱਪ ਵਾਲੇ ਸਥਾਨ 'ਤੇ ਪਹੁੰਚਾ ਦਿਓ ਅਤੇ ਸਾਡਾ ਟਰਿੱਪ ਮੈਕਲੋਡਗੰਜ ਲਈ ਬਣਾਇਆ ਹੈ ਅਤੇ ਅਸੀਂ ਹੋਰ ਵੀ ਲਾਗੇ ਲਾਗੇ ਦੀਆਂ ਥਾਵਾਂ ਨੂੰ ਘੁੰਮਣਾ ਚਾਹਵਾਂਗੇ ਅਸੀਂ ਇੱਕ ਦਿਨ ਦਾ ਹੀ ਟਰਿੱਪ ਪਲੈਨ ਕੀਤਾ ਹੈ ਅਤੇ ਇੱਕ ਦਿਨ ਲਈ ਹੀ ਸਾਨੂੰ ਤੁਹਾਡੀ ਉਬਰ ਬੁਕ ਕਰਨੀ ਪੈ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਜਲਦੀ ਹੀ ਸਾਡੀ ਗੱਲ ਦਾ ਜਵਾਬ ਦੇ ਕੇ ਅਤੇ ਆਪਣਾ ਪੂਰੀ ਰਕਮ ਜਾਂ ਫੀਸ ਦੀ ਇੰਨਫੋਰਮੇਸ਼ਨ ਐਸ ਐਮ ਐਸ ਰਾਹੀਂ ਸਾਨੂੰ ਦੇ ਦੇਵੋਗੇ